ਸਤਿ ਸ੍ਰੀ ਅਕਾਲ ਸਰ ਮੈਂ ਇਸੇ ਫੋਨ ਨੰਬਰ ਬਾਹਠ ਤ੍ਰਿਆਸੀ ਇਕੱਤੀ ਇਕਾਹਠ ਚੌਂਤੀ ਤੋਂ ਹੁਣੇ ਕੁੱਝ ਦੇਰ ਪਹਿਲਾਂ ਤੁਹਾਨੂੰ ਇੱਕ ਔਡਰ ਦਿੱਤਾ ਸੀ ਜਿਸ ਵਿੱਚ ਖਾਣ ਦੀਆਂ ਕੁੱਝ ਚੀਜ਼ਾਂ ਸੀ ਜਿਵੇਂ ਕਿ ਪੀਜ਼ਾ ਟਿੱਕੀ ਬਰਗਰ ਪਰ ਹੁਣੇ ਮੈਨੂੰ ਕੋਈ ਐਮਰਜੈਂਸੀ ਕਰਕੇ ਬਾਹਰ ਜਾਣਾ ਪੈ ਰਿਹਾ ਏ ਜਿਸ ਕਰਕੇ ਮੈਂ ਔਡਰ ਰਸੀਵ ਨਹੀਂ ਕਰ ਸਕਦਾ ਅਤੇ ਮੈਨੂੰ ਆਪਣਾ ਇਹ ਔਡਰ ਕਿਸੇ ਕਾਰਨ ਵਸ਼ ਕੈਂਸਲ ਕਰਨਾ ਪੈਣਾ ਹੈ ਇਸ ਕਰਕੇ ਮੈਂ ਤੁਹਾਨੂੰ ਇਹ ਜਾਣਕਾਰੀ ਸਮੇਂ ਸਿਰ ਦੇ ਰਿਹਾ ਹਾਂ ਤਾਂ ਕਿ ਜੋ ਚੀਜ਼ ਮੈਂ ਦਿੱਤੀ ਹੈ ਉਹ ਬਰਬਾਦ ਨਾ ਹੋ ਸਕੇ ਅਤੇ ਉਹ ਸਹੀ ਚੀਜ਼ ਇਸਤੇਮਾਲ ਹੋ ਸਕੇ ਮੇਰੇ ਐਮਰਜੈਂਸੀ ਕਾਰਨ ਹਨ ਕਿ ਮੇਰਾ ਕੋਈ ਆਪਣਾ ਜਾਨਣ ਵਾਲਾ ਉਸਦਾ ਐਕਸੀਡੈਂਟ ਹੋ ਗਿਆ ਜਿਸ ਕਰਕੇ ਮੈਨੂੰ ਜਲਦੀ 'ਚ ਉਹਨੂੰ ਦੇਖਣ ਲਈ ਜਾਣ ਲਈ ਪੈ ਰਿਹਾ ਹੈ ਅਤੇ ਮੈਂ ਆਪਣਾ ਔਡਰ ਕੈਂਸਲ ਕਰ ਰਿਹਾ ਹਾਂ ਮੇਰਾ ਆਰਡਰ ਨੰਬਰ ਇੱਕ ਦੋ ਚਾਰ ਪੰਜ ਛੇ ਸੱਤ ਹੈ ਜੋ ਕਿ ਮੈਂ ਹੁਣ ਤੋਂ ਪੰਦਰਾਂ ਮਿੰਟ ਪਹਿਲਾਂ ਕੀਤਾ ਸੀ ਮੈਂ ਬਹੁਤ ਬਹੁਤ ਮਾਫੀ ਚਾਹੁੰਦਾ ਹਾਂ ਤੁਹਾਡੇ ਤੋਂ ਇਸ ਔਡਰ ਦੇ ਕੈਂਸਲ ਹੋਣ ਲਈ ਪਰ ਇਹ ਮੇਰੀ ਮਜਬੂਰੀ ਹੈ ਅਤੇ ਮੈਂ ਸਮਝਦਾ ਹਾਂ ਤੁਸੀਂ ਮਜਬੂਰੀ ਨੂੰ ਸਮਝਦੇ ਹੋਏ ਮੇਰਾ ਔਡਰ ਕੈਂਸਲ ਕਰਕੇ ਇਸ ਨੂੰ ਇੱਕ ਸਹੀ ਤੌਰ 'ਤੇ ਲਵੋਗੇ ਅਤੇ